ਮੇਰੇ ਸਕੂਲ ਦੇ ਵਿੱਚ ਲਾਇਬ੍ਰੇਰੀ ਹੈ ਜਿੱਥੇ ਸਾਰੀ ਪ੍ਰਕਾਰ ਦੀਆਂ ਕਿਤਾਬਾਂ ਮੌਜੂਦ ਹਨ ਜਿੱਥੇ ਮੈਂ ਆਪਣਾ ਪੰਜਾਬੀ ਸਾਹਿਤ ਪੜ੍ਹੀ ਹੈ ਅਤੇ ਹੋਰ ਧਾਰਮਿਕ ਕਿਤਾਬਾਂ ਪੜ੍ਹੀਆਂ ਨੇ ਜਿਨ੍ਹਾਂ ਦੇ ਨਾਲ ਬੜਾ ਗਿਆਨ ਮਿਲਿਆ ਹੈ ਅਤੇ ਬੜਾ ਵਧੀਆ ਲੱਗਦਾ ਜਦੋਂ ਅਸੀਂ ਆਪਣੀਆਂ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਦੇ ਨੇ ਜਾਂ ਪੰਜਾਬੀ ਮਾਂ ਬੋਲੀ ਦੇ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ